ਸਾਡਾ ਰੂਪਨਗਰ ਇੱਕ ਬਹੁਤ ਹੀ ਸੁੰਦਰ ਸਥਾਨ ਹੈ ਅਤੇ ਇੱਥੇ ਵੱਖ ਵੱਖ ਤਰ੍ਹਾਂ ਦੇ ਫਾਊਂਡੇਸ਼ਨ ਵੀ ਚਲਾਏ ਜਾਂਦੇ ਹਨ ਜਿਵੇਂ ਕਿ ਅੰਬੂਜਾ ਫਾਊਡੇਸ਼ਨ ਅਤੇ ਵੈਲਫੇਅਰ ਸੋਸਾਇਟੀਜ ਵੀ ਹਨ ਜਿਵੇਂ ਪ੍ਰਕਾਸ਼ ਡੈਫ ਐਂਡ ਡੰਮ ਵੈੱਲਫੇਅਰ ਸੋਸਾਇਟੀ ਮਹਿਲ ਵੈੱਲਫੇਅਰ ਸੋਸਾਇਟੀ ਅਤੇ ਹੋਰ ਵੀ ਹੋਰ ਵੀ ਬਹੁਤ ਸਾਰੇ ਸੋਸਾਇਟੀ ਹਨ ਓਲਡ ਏਜ ਹੋਮਸ ਵੀ ਹਨ ਬ ਬਜ਼ੁਰਗਾਂ ਦੇ ਲਈ ਘਰ ਵੀ ਹਨ ਅਤੇ ਹਰ ਸ ਹਰ ਸਥਾਨ ਦੇ ਵਿੱਚ ਹਰ ਥਾਂ ਥਾਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਸਮੇਂ ਸਮੇਂ ਦੇ ਵਿੱਚ ਹਰ ਸਹੂਲਤਾਂ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਪ ਰੂਪਨਗਰ ਦੇ ਵਿੱਚ ਸਰਕਾਰੀ ਫ੍ਰੀ ਸ ਸਰਕਾਰੀ ਸਕੂਲਾਂ ਵੀ ਹੈ ਜਿੱਥੇ ਬੱਚਿਆਂ ਨੂੰ ਫ੍ਰੀ ਸਿੱਖਸ਼ਾ ਵੀ ਮਿਲਦੀ ਹੈ ਅਤੇ ਕਈ ਕਈ ਡੈਫ ਐਂਡ ਡੰਮ ਸਕੂਲਜ਼ ਵੀ ਹਨ ਜਿੱਥੇ ਬੱ ਜਿਹੜੇ ਡੈਫ ਐਂਡ ਡੰਮ ਬੱਚੇ ਹੈ ਉਹਨਾਂ ਨੂੰ ਨਈਂ ਨਈਂ ਤਕਨੀਕ ਸਿਖਾਈ ਜਾਂਦੀ ਹਨ ਜੋ ਕਿ ਉਹ ਕੁਝ ਕ ਆਪਣੀ ਲਾਈਫ਼ ਦੇ ਵਿੱਚ ਕੁਝ ਕਰ ਸਕਣ ਅਤੇ ਕਿਤੇ ਨਾ ਕਿਤੇ ਰੂਪਨਗਰ ਆਪੋ ਆਪ ਦੇ ਵਿੱਚ ਹੀ ਬਹੁਤ ਕੁਝ ਪੰ ਬਹੁਤ ਕੁਝ ਦੇ ਰਿਹਾ ਹੈ ਅਤੇ ਇੱਥੇ ਦੇ ਇੱਥੇ ਦਾ ਨੌਜਵਾਨ ਵੀ ਸਹਿਯੋਗ ਕਰਦਾ ਹੈ